ਮੈਨੂੰ ਸ਼ੁਰੂ ਤੋਂ ਹੀ ਨੱਚਣ ਦਾ ਬਹੁਤ ਸ਼ੌਕ ਸੀ ਜਦੋਂ ਵੀ ਕੋਈ ਮੈਂ ਗੀਤ ਸੁਣਦੀ ਕੋਈ ਰੇਡੀਓ 'ਤੇ ਜਾਂ ਟੀ ਵੀ 'ਤੇ ਅਤੇ ਮੈਂ ਨੱਚਣਾ ਸ਼ੁਰੂ ਕਰ ਦਿੰਦੀ ਐਂ ਥੋੜ੍ਹਾ ਥੋੜ੍ਹਾ ਨੱਚਦੇ ਨੱਚਦੇ ਮੈਨੂੰ ਇੱਕ ਵਧੀਆ ਨੱਚਣਾ ਜਾਂ ਡਾਂਸ ਕਰਨਾ ਆ ਗਿਆ ਅਤੇ ਇਹ ਪਹਿਲਾਂ ਤਾਂ ਮੈਂ ਥੋੜ੍ਹਾ ਹੀ ਨੱਚਦੀ ਸੀ ਜਿਉਂ ਜਿਉਂ ਮੈਂ ਗੀਤ ਸੁਣਦੀ ਗਈ ਤਾਂ ਮੇਰਾ ਡਾਂਸ ਵੱਲ ਇੰਟਰਸਟ ਵੱਧਦਾ ਗਿਆ ਇਸ ਲਈ ਹੁਣ ਮੈਂ ਬਹੁਤ ਵਧੀਆ ਡਾਂਸ ਕਰ ਲੈਂਦੀ ਹਾਂ ਅਤੇ ਮੈਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਨੱਚ ਕੇ ਕਰਦੀ ਹਾਂ ਸਾਡੇ ਪਿੰਡ ਵਿੱਚ ਵੀ ਮੇਰੇ ਤਰ੍ਹਾਂ ਦੇ ਬਹੁਤ ਬਹੁਤ ਸਾਰੇ ਡਾਂਸਰ ਹਨ ਜੋ ਬਹੁਤ ਸਮਿਆਂ ਸਮਿਆਂ 'ਤੇ ਪ੍ਰੋਗਰਾਮਾਂ 'ਤੇ ਨੱਚਦੇ ਹਨ ਮੈਂ ਵੀ ਉਹਨਾਂ ਨਾਲ ਜਾ ਕੇ ਉਹੀ ਖੁਸ਼ੀ ਦਾ ਪ੍ਰਗਟਾਵਾ ਕਰਦੀ ਹਾਂ ਮੈਨੂੰ ਨੱਚਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜਦੋਂ ਮੈਂ ਕਿਸੇ ਨੂੰ ਨੱਚਦਾ ਦੇਖਦੀ ਹਾਂ ਤਾਂ ਮੇਰਾ ਬਹੁਤ ਦਿਲ ਕਰਦਾ ਕਿ ਮੈਂ ਵੀ ਇਸ ਤਰ੍ਹਾਂ ਹੀ ਨੱਚਾਂ ਇਹ ਸਾਰੇ ਸਾਡੇ ਸਾਡੇ ਪਿੰਡ ਵਿੱਚ ਜਦੋਂ ਵੀ ਸਾਂਝਾ ਸਮਾਗਮ ਹੁੰਦਾ ਹੈ ਤਾਂ ਸਾਰੀਆਂ ਕੁੜੀਆਂ ਅਤੇ ਮੁੰਡੇ ਰਲ ਮਿਲ ਕੇ ਉੱਥੇ ਭੰਗੜਾ ਪਾਉਂਦੇ ਹਨ ਅਤੇ ਗਿੱਧਾ ਪਾਉਂਦੇ ਹਨ ਇਹ ਸਾਂਝੇ ਸਮਿਆਂ ਅਤੇ ਖੁਸ਼ੀਆਂ ਨੂੰ ਮਨਾਉਣ ਦਾ ਢੰਗ ਹੈ ਮੌਕੇ 'ਤੇ ਲੋਕ ਇਕੱਠੇ ਹੋ ਕੇ ਗੀਤ ਗਾਉਂਦੇ ਹਨ ਅਤੇ ਨੱਚਦੇ ਹਨ ਜੋ ਸੰਸਕ੍ਰਿਤਿਕ ਕਲਾਵਾਂ ਨੂੰ ਜੀਵਤ ਰੱਖਦਾ ਹੈ ਇਸ ਨਾਲ ਸਾਥੀਆਂ ਅਤੇ ਭਾਈਚਾਰੇ ਦਾ ਭਾਵ ਆਉਂਦਾ ਹੈ ਅਤੇ ਦੁੱਖ ਸੁੱਖ ਸਾਂਝੇ ਕਰਨਾ ਆਸਾਨ ਹੁੰਦਾ ਹੈ ਮੈਂ ਵੀ ਇਸ ਵਿੱਚ ਭਾਗ ਲੈ ਕੇ ਆਪਣੀ ਮੌਜ ਮਾਣ ਕੇ ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ ਡਾਂਸ ਸਾਡੇ ਪਿੰਡ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਦਾ ਇੱਕ ਅਟੁੱਟ ਅੰਗ ਹੈ ਇਹ ਵੱਖ ਵੱਖ ਮੌਕਿਆਂ 'ਤੇ ਜਿਵੇਂ ਤਿਉਹਾਰ ਵਿਆਹਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਕੀਤਾ ਜਾਂਦਾ ਹੈ ਲੋਕ ਡਾਂਸ ਨਾਲ ਆਪਣੇ ਅਨੁਭਵਾਂ ਨੂੰ ਵਿਅਕਤ ਕਰਦੇ ਹਨ ਅਤੇ ਮੌਕੇ ਦੀ ਖੁਸ਼ੀ ਨੂੰ ਸਾਂਝਾ ਕਰਦੇ ਹਨ ਡਾਂਸ ਰੂਪ ਵਿੱਚ ਲੋਕ ਨਾਚ ਭੰਗੜਾ ਗਿੱਧਾ ਅਤੇ ਹੋਰ ਰਿਵਾਇਤਾਂ ਨ੍ਰਿਤ ਸ਼ਾਮਿਲ ਹਨ ਜੋ ਹਰ ਪਿੰਡ ਦੇ ਆਪਣੇ ਵਿਸ਼ੇਸ਼ ਰੰਗ ਨੂੰ ਦਿਖਾਉਂਦੇ ਹਨ ਇਸ ਨਾਲ ਸਿੱਖਿਆ ਸੰਸਕ੍ਰਿਤੀ ਅਤੇ ਪੀੜ੍ਹੀਆਂ ਦੇ ਵਿਚਕਾਰ ਸੰਪਰਕ ਬਣਦਾ ਹੈ ਇਸ ਤਰ੍ਹਾਂ ਡਾਂਸ ਸਿਰਫ ਮਨੋਰੰਜਨ ਦਾ ਹੀ ਨਹੀਂ ਸਗੋਂ ਸਾਂਝੇਦਾਰੀ ਅਤੇ ਪਿਆਰ ਦਾ ਇੱਕ ਬਹੁਤ ਮਹੱਤਵਪੂਰਨ ਤਰੀਕਾ ਹੈ ਡਾਂਸ ਕਰਨਾ ਹਰ ਇੱਕ ਨੂੰ ਨਹੀਂ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਜਦੋਂ ਕੋਈ ਭੰਗੜਾ ਪਾਉਂਦਾ ਹੈ ਜਾਂ ਡਾਂਸ ਕਰਦਾ ਹੈ ਤਾਂ ਉਸ ਦਾ ਪੈਰ ਆਪਣੇ ਆਪ ਹੀ ਹਿੱਲਣ ਲੱਗ ਜਾਂਦਾ